ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਉਬਰ ਤੋਂ ਗੱਲ ਕਰ ਰਹੇ ਮੈਂ ਮਨਮੀਤ ਸਿੰਘ ਤਰਨ ਤਾਰਨ ਸ਼ਹਿਰ ਤੋਂ ਬੋਲ ਰਿਹਾ ਹਾਂ ਮੈਂ ਪਿਛਲੀ ਵਾਰ ਵੀ ਤੁਹਾਡੀ ਏਜੰਸੀ 'ਚੋਂ ਹੀ ਕੈਬ ਬੁੱਕ ਕਰਕੇ ਚੰਡੀਗੜ੍ਹ ਆਪਣੇ ਯਾਰਾਂ ਮਿੱਤਰਾਂ ਨਾਲ ਘੁੰਮਣ ਗਿਆ ਸੀ ਉਹ ਵੀ ਟਰਿੱਪ ਮੇਰਾ ਬਹੁਤ ਵਧੀਆ ਗਿਆ ਮਿਸਟਰ ਸੁਰੇਸ਼ ਨਾਂ ਦਾ ਡਰਾਇਵਰ ਜੋ ਕਿ ਉਬਰ ਏਜੰਸੀ ਤੋਂ ਸੀ ਉਹਨੇ ਸਾਨੂੰ ਘੁੰਮਾਇਆ ਸਾਨੂੰ ਪੂਰੀ ਟਰਿਪ ਦਾ ਆਨੰਦ ਬਹੁਤ ਜ਼ਿਆਦਾ ਆਇਆ ਕਿਉਂਕਿ ਉਹਨੂੰ ਬਹੁਤ ਜ਼ਿਆਦਾ ਨੌਲੇਜ ਸੀ ਵੱਖਰੀ ਵੱਖਰੀ ਜਗ੍ਹਾਵਾਂ ਬਾਰੇ ਉਹ ਹਰ ਇੱਕ ਜਗ੍ਹਾ ਦੀ ਵਿਸ਼ੇਸ਼ਤਾਵਾਂ ਦੱਸਦਾ ਸੀ ਜਿਹਦੇ ਬਾਰੇ ਸਾਨੂੰ ਬਿਲਕੁਲ ਵੀ ਜਾਣਕਾਰੀ ਨਹੀਂ ਸੀ ਹੁਣ ਇੱਕ ਹਫਤੇ ਬਾਅਦ ਮੇਰੀ ਕੈਨੇਡਾ ਤੋਂ ਪੂਰੀ ਫੈਮਿਲੀ ਪੰਜਾਬ ਆ ਰਹੀ ਹੈ ਅਤੇ ਮੈਂ ਚਾਹੁੰਦਾ ਹਾਂ ਮੈਂ ਮਿਸਟਰ ਸੁਰੇਸ਼ ਜੀ ਨੂੰ ਦੁਬਾਰਾ ਆਪਣੀ ਕੈਬ ਦੇ ਲਈ ਬੁੱਕ ਕਰਾਂ ਤਾਂ ਜੋ ਮੇਰਾ ਇਹ ਜਰਨੀ ਵੀ ਬਹੁਤ ਵਧੀਆ ਰਹੇ ਅਸੀਂ ਪਹਿਲਾਂ ਚੰਡੀਗੜ੍ਹ ਜਾਣਾ ਜਾਵਾਂਗੇ ਉਸ ਤੋਂ ਬਾਅਦ ਅਸੀਂ ਸ਼ਿਮਲਾ ਦਾ ਵੀ ਪਲੈਨ ਕਰ ਰਹੇ ਹਾਂ ਕਿਉਂਕਿ ਮੇਰੀ ਫੈਮਿਲੀ ਚਾਹੁੰਦੀ ਹੈ ਕਿ ਪਹਾੜੀ ਇਲਾਕੇ ਦਾ ਵੀ ਆਨੰਦ ਮਾਣਿਆ ਜਾਵੇ ਸੋ ਮੇਰੀ ਬੇਨਤੀ ਹੈ ਕਿ ਮਿਸਟਰ ਸੁਰੇਸ਼ ਜੀ ਨੂੰ ਦੁਬਾਰਾ ਉਪਲਬਧ ਕਰਵਾਇਆ ਜਾਵੇ ਤਾਂ ਜੋ ਮੈਂ ਇਹ ਯਾਤਰਾ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇੰਜੋਏ ਕਰ ਸਕਾਂ ਉਮੀਦ ਹੈ ਕਿ ਤੁਸੀਂ ਛੇਤੀ ਇਸ ਮਸਲੇ ਦਾ ਹੱਲ ਕਰੋਗੇ ਧੰਨਵਾਦ ਜੀ